ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਪੰਜਾਬੀ ਨੂੰ ਮੁੱਖ ਤੌਰ 'ਤੇ ਆਪਣੇ ਘਰ ਅਤੇ ਬਾਹਰ ਵਰਤਦੇ ਹਾਂ ਪਰ ਜ਼ਰੂਰੀ ਨਹੀਂ ਕਿ ਹਰ ਕੋਈ ਪੰਜਾਬੀ ਪੜ੍ਹਦਾ ਅਤੇ ਸਮਝਦਾ ਹੋਵੇ ਸਾਨੂੰ ਕਈ ਵਾਰ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨਾ ਪੈਂਦਾ ਹੈ ਜਿਸ ਕਾਰਨ ਕਈ ਵਾਰ ਉਹਨਾਂ ਦੇ ਅਰਥ ਉਲਟ ਜਾਂਦੇ ਹਨ ਜਾਂ ਤਾਂ ਉਹਨਾਂ ਨੂੰ ਸਮਝਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਜਾਂ ਤਾਂ ਉਹ ਉਸ ਨੂੰ ਚੰਗੀ ਤਰ੍ਹਾਂ ਉਸ ਅਰਥ ਵਿੱਚ ਸਮਝਿਆ ਨਹੀਂ ਜਾ ਸਕਦਾ ਪਰ ਪਰ ਸਾਹਿਤਿਕ ਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਜਿੱਥੇ ਵਧੇਰੇ ਸੌਖਾ ਅਤੇ ਸਰਲ ਹੈ ਉਥੇ ਹੀ ਇਸ ਨੂੰ ਸਮਝਣਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਪਰ ਸਾਹਿਤਿਕ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਅਸੀਂ ਉਹਨਾਂ ਨੂੰ ਹਰ ਭਾਸ਼ਾ ਦੇ ਵਿੱਚ ਬੱਚਿਆਂ ਨੂੰ ਸਮਝਾ ਸਕਦੇ ਹਾਂ ਹਰ ਕਿਸੇ ਵਰਗ ਨੂੰ ਸਹੀ ਢੰਗ ਦੇ ਨਾਲ ਸਮਝਾ ਸਕਦੇ ਹਾਂ ਜਿਸ ਨਾਲ ਉਹ ਹਰ ਸਾਹਿਤਿਕ ਨੂੰ ਚੰਗੇ ਢੰਗ ਦੇ ਨਾਲ ਪੜ੍ਹ ਅਤੇ ਸੁਣ ਸਕਦੇ ਹਨ ਜਿਸ ਨਾਲ ਉਹਨਾਂ ਦੀ ਅਗਲੀ ਅਗਲੇਰੀ ਸਿੱਖਿਆ ਦੇ ਵਿੱਚ ਹੋਰ ਵਾਧਾ ਹੁੰਦਾ ਹੈ ਇਸ ਵਿੱਚ ਚੁਣੌਤੀ ਸਿਰਫ਼ ਅਰਥਾਂ ਵਿੱਚ ਤਬਦੀਲੀ ਦੇ ਕਾਰਨ ਹੀ ਆਉਂਦੀ ਹੈ ਇਸ ਤੋਂ ਇਲਾਵਾ ਸਮਝਣ ਦੇ ਵਿੱਚ ਕਈ ਵਾਰ ਥੋੜ੍ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ